ਛੱਬੀ ਜਨਵਰੀ ਉੱਨੀ ਸੌ ਪੰਜਾਹ ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਤੇਈ ਜਨਵਰੀ ਉੱਨੀ ਸੌ ਚੁਰਾਨਵੇਂ ਦੋ ਫਰਵਰੀ ਉੱਨੀ ਸੌ ਨੜਿਨਵੇਂ ਸੱਤ ਅਕਤੂਬਰ ਦੋ ਹਜ਼ਾਰ ਤੀਹ